ਪੰਜਾਬੀ ਸਾਹਿਤ ਦੀ ਜੇ ਗੱਲ ਕਰੀਏ ਤਾਂ ਦੋ ਹੀ ਚੀਜ਼ਾਂ ਜਿਹੜੀਆਂ ਮੈਨੂੰ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦੀਆਂ ਨੇ ਪਿਆਰ ਅਤੇ ਕੁਰਬਾਨੀ ਕੁਰਬਾਨੀ ਸਾਡੇ ਗੁਰੂ ਸਾਹਿਬਾਨਾਂ ਦੇ ਟਾਈਮ ਤੋਂ ਸਾਨੂੰ ਦੇਖਣ ਨੂੰ ਮਿਲਦੀ ਹੈ ਉਹ ਵੀ ਪਿਆਰ ਦੇ ਬੇਸ 'ਤੇ ਰਹੀ ਨਹੀਂ ਧਰਮ ਨਾਲ ਪਿਆਰ ਸੀ ਪੰਜਾਬੀਆਂ ਨਾਲ ਪਿਆਰ ਸੀ ਪੰਜਾਬੀਅਤ ਨਾਲ ਪਿਆਰ ਸੀ ਉਹਦੇ ਵਾਸਤੇ ਸਾਡੇ ਗੁਰੂ ਸਾਹਿਬਾਨਾ ਨੇ ਕੁਰਬਾਨੀ ਦਿੱਤੀ ਤਾਂ ਥੋੜ੍ਹਾ ਜਿਹਾ ਦੇਖੋ ਮਹਾਨ ਸ਼ਖਸ਼ੀਅਤਾ ਸੀ ਨੋਰਮਲ ਬੰਦੇ ਦੀ ਵੀ ਜੇ ਗੱਲ ਕਰ ਲਈਏ ਹੀਰ ਰਾਂਝਾ ਸੱਸੀ ਪੰਨੂੰ ਸੋਹਣੀ ਮਹੀਂਵਾਲ ਮਿਰਜ਼ਾ ਸਾਹਿਬਾ ਇਹ ਸਾਡੇ ਲਿਟਰੇਚਰ ਦਾ ਸਾਡੇ ਸਾਹਿਤ ਦਾ ਹਿੱਸਾ ਨੇ ਜੇ ਇਹਨਾਂ ਦੀ ਸੂਰਿਆ ਸਟੋਰੀ ਆਪਾਂ ਪੜ੍ਹੀਏ ਤਾਂ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਹੀ ਦੋ ਚੀਜ਼ਾਂ ਪਿਆਰ ਅਤੇ ਪਿਆਰ ਲਈ ਕੁਰਬਾਨੀ ਮਤਲਬ ਹੀਰ ਨੇ ਰਾਂਝੇ ਨੂੰ ਚੂਰੀ ਖੁਆਈ ਰਾਂਝੇ ਨੇ ਹੀਰ ਵਾਸਤੇ ਚ ਮੱਝੀਆਂ ਚਾਰੀਆਂ ਮਿਰਜਾ ਸਾਹਿਬਾਂ ਵਾਸਤੇ ਕੁ ਆਪਣੀ ਜਾਨ ਕੁਰਬਾਨ ਕਰ ਗਿਆ ਸੱਸੀ ਪੁੰਨੂ ਦੀ ਸਟੋਰੀ ਲੈ ਲਓ ਸੋਹਣੀ ਮਹੀਂਵਾਲ ਜਿੱਥੇ ਮਹੀਵਾਲ ਨੇ ਆਪਣਾ ਪੱਟ ਚੀਰ ਕੇ ਖਵਾਇਆ ਅਤੇ ਸੋਹਣੀ ਨੇ ਵੀ ਪਿਆਰ ਦੇ ਵਾਸਤੇ ਕੁਰਬਾਨੀਆਂ ਆਪਣੀ ਦਿੱਤੀ ਕੱਚੇ ਘੜੇ ਦੇ ਆਸਰੇ ਹੀ ਨਦੀ ਤੋਂ ਪਾਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਇਹ ਹੀ ਜਿਹੜੀਆਂ ਦੋ ਚੀਜ਼ਾਂ ਨੇ ਪਿਆਰ ਅਤੇ ਪਿਆਰ ਵਾਸਤੇ ਕੁਰਬਾਨੀ ਪੰਜਾਬੀ ਸਾਹਿਤ ਨੂੰ ਦੁਨੀਆਂ ਦੇ ਵਿੱਚ ਇਕ ਅਲੱਗ ਮੁਕਾਮ ਦਿੰਦੀਆਂ ਨੇ ਰ ਪਿਆਰ ਹਰ ਕੋਈ ਕਰਦਾ ਪਰ ਪਿਆਰ ਦੀ ਕੁਰਬਾਨੀ ਦੇਣਾ ਸਭ ਤੋਂ ਵੱਡੀ ਚੀਜ਼ ਹੈ ਪੰਜਾਬੀ ਅੱਗੇ ਰਹਿੰਦੇ ਨੇ ਹਮੇਸ਼ਾ ਕੁਰਬਾਨੀ ਵਾਸਤੇ ਚਾਹੇ ਉਹ ਪਿਆਰ ਵਾਸਤੇ ਹੋਵੇ ਉਹ ਪਿਆਰ ਦੋ ਜਿਸਮਾਂ ਦਾ ਹੋ ਸਕਦਾ ਦੋ ਰੂਹਾਂ ਦਾ ਹੋ ਸਕਦਾ ਉਹ ਪਿਆਰ ਦੇਸ਼ ਲਈ ਹੋ ਸਕਦਾ ਉਹ ਪਿਆਰ ਕੌਮ ਲਈ ਹੋ ਸਕਦਾ ਉਹ ਪਿਆਰ ਧਰਮ ਲਈ ਹੋ ਸਕਦਾ ਹਰ ਚੀਜ਼ ਦੇ ਨਾਲ ਜਿੱਥੇ ਜਿੱਥੇ ਪਿਆਰ ਔਰ ਉਹਦੇ ਵਾਸਤੇ ਕੁਰਬਾਨੀ ਦੀ ਗੱਲ ਆਈ ਹੈ ਪੰਜਾਬੀ ਸਭ ਤੋਂ ਅੱਗੇ ਰਹੇ ਨੇ